ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਸੁਖਮਨੀ ਕੌਰ ਹਾਂਜੀ ਸਰ ਹਾਂਜੀ ਸਰ ਸਰ ਦੋ ਤਿੰਨ ਪ੍ਰੋਬਲਮਾਂ ਹੈਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ਼ ਡਿ ਡਿਸਕਸ ਕਰਨਾ ਚਾਹੂੰਗੀ ਸਰ ਪਹਿਲੀ ਪ੍ਰੋਬਲਮ ਹੈ ਕਿ ਸਕੂਲ ਦੇ ਜਿਹੜੇ ਵਾਸ਼ਰੂਮਜ਼ ਨੇ ਉਹ ਇੰਨੇ ਕਲੀਨ ਨਹੀਂ ਹੈਗੇ ਅਤੇ ਕੁਝ ਪਾਣੀ ਦੀ ਫਸਿਲਿਟੀ ਵੀ ਇੰਨੀ ਵਧੀਆ ਨਹੀਂ ਹੈ ਸਰ ਸਾਡੇ ਸਕੂਲ ਪਹਿਲਾਂ ਨਾ ਕੰਪਿਊਟਰ ਦੀ ਕਲਾਸ ਹੁੰਦੀ ਸੀ ਅਤੇ ਹੁਣ ਕੰਪਿਊਟਰ ਦੀ ਕਲਾਸ ਬੰਦ ਕਰ ਦਿੱਤੀ ਹੈ ਕਿਉਂਕਿ ਸਕੂਲ ਦੇ ਵਿੱਚ ਕੰਪਿਊਟਰਸ ਇੰਨੇ ਅਵੇਲੇਬਲ ਨਹੀਂ ਹੈਗੇ ਦੋ ਤਿੰਨ ਹੈਗੇ ਆ ਅਤੇ ਉਹ ਵੀ ਸਹੀ ਚਲਦੇ ਨਹੀਂ ਅਤੇ ਕੰਪਿਊਟਰ ਦੀ ਕਲਾਸ ਬੰਦ ਕਰਵਾ ਦਿੱਤੀ ਆ ਹਾਂਜੀ ਸਰ ਸਰ ਬਾਕੀ ਸਭ ਤਾਂ ਵਧੀਆ ਚੱਲ ਰਿਹਾ ਵਾ ਇੱਕ ਹੋਰ ਪ੍ਰੋਬਲਮ ਸੀ ਕਿ ਫਿਜ਼ੀਕਲ ਐਜੂਕੇਸ਼ਨ ਚਾਹੀਦੀ ਹੈ ਸਪੋਰਟਸ ਵਗੈਰਾ ਨਹੀਂ ਹੁੰਦੀ ਕੋਈ ਵੀ ਐਕਟੀਵਿਟੀਜ਼ ਨਹੀਂ ਹੈਗੀਆਂ